ਸਾਡੇ ਬਹੁਤ ਹੀ ਪ੍ਰਸਿੱਧ ਸਥਾਨ ਮੰਡੀ ਗੋਬਿੰਦਗੜ੍ਹ ਹੈ ਮਨ ਜਿੱਥੇ ਕਿ ਅੰਡਸਟਰੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਅਤੇ ਸਾਡੇ ਨੌਜਵਾਨਾਂ ਨੂੰ ਉਸ ਇੰਡਸਟਰੀਆਂ ਤੋਂ ਬਹੁਤ ਕੰਮ ਮਿਲਦਾ ਹੈ ਜਿਵੇਂ ਕਿ ਵੱਖ ਵੱਖ ਇੰਡਸਟਰੀਆਂ ਦੇ ਵਿੱਚ ਕੋਈ ਅਕਾਊਂਟ ਦਾ ਕੰਮ ਕਰਦਾ ਹੈ ਕੋਈ ਡਰਾਈਵਰੀ ਕਰਦਾ ਹੈ ਅਤੇ ਕੋਈ ਚੌਂਕੀਦਾਰੀ ਕਰਦਾ ਹੈ ਅਤੇ ਕਈ ਹੋਰ ਕੰਮ ਵੀ ਕਰਦੇ ਹਨ ਅਤੇ ਸਾਡੇ ਨੌਜਵਾਨ ਉੱਥੇ ਜਿਵੇਂ ਵੀ ਕੰਮ ਮਿਲਦਾ ਹੈ ਉੱਥੇ ਉਹ ਕਰਦੇ ਨੇ ਅਤੇ ਸਾਡੇ ਇਲਾਕੇ ਨੂੰ ਹੀ ਗੋਬਿੰਦਗੜ੍ਹ ਦਾ ਗੋਬਿੰਦਗੜ੍ਹ ਤੋਂ ਬਹੁਤ ਜ਼ਿਆਦਾ ਕੰਮ ਮਿਲਦਾ ਹੈ ਅਤੇ ਨੌਜਵਾਨ ਪੜ੍ਹੇ ਲਿਖਿਆਂ ਨੂੰ ਸਾਰਿਆਂ ਨੂੰ ਬਹੁਤ ਰੋਜ਼ਗਾਰ ਮਿਲਦਾ ਹੈ